ਹੈਲੋ ਸਤਿ ਸ਼੍ਰੀ ਅਕਾਲ ਹਾਂਜੀ ਹਾਂਜੀ ਹਾਂਜੀ ਸ਼ਹੀਦੀ ਸਿੰਘ ਗੁਰਦੁਆਰੇ ਤੋਂ ਬੋਲ ਰਹੇ ਹਾਂਜੀ ਹਾਂਜੀ ਟਕਸਾਲ ਵਿੱਚ ਅੱਛਾ ਜੀ ਹਾਂਜੀ ਦੇਖੋ ਬੱਚੇ ਨੂੰ ਆਪਾਂ ਜੀਵਨ ਜਾਂਚ ਸਿਖਾਉਂਦੇ ਹਾਂ ਰਹਿਣ ਸਹਿਣ ਦਾ ਜਿਵੇਂ ਬੱਚੇ ਨੂੰ ਆਪਾਂ ਅਧਿਆਤਮਿਕ ਤੌਰ ਨਾਲ ਜੋੜਨ ਦੇ ਜੇ ਆਪਾਂ ਕਹਿ ਸਕਦੇ ਸਹਿਜ ਪਾਠ ਸਿਖਾਉਂਦੇ ਆਪਾਂ ਸੰਥਿਆ ਨਿਤਨੇ ਨਿਤਨੇਮ ਪਾਠ ਅਤੇ ਜੇਕਰ ਬੱਚੇ 'ਚ ਕਲਾ ਹੋਵੇ ਤਾਂ ਆਪਾਂ ਜਿਵੇਂ ਕੀਰਤਨ ਵੱਲ ਵੀ ਜੋੜ ਦਿਨੇ ਜਿਵੇਂ ਆਪਾਂ ਕਹਿ ਸਕਦੇ ਹਾਂ ਹਰ ਸਾਜ਼ ਸਿਖਾਉਂਦੇ ਹਾਂ ਹਰਮੋਨੀਅਮ ਜਾਂ ਆਪਾਂ ਤਬਲਾ ਕਹਿ ਸਕਦੇ ਹਾਂ ਹਾਂਜੀ ਉਹ ਸਿਖਾਉਂਦੇ ਹੈਗੇ ਆਪਾਂ ਹਾਂਜੀ ਹਾਂਜੀ ਗੱਤਕਾ ਵੀ ਸਿਖਾਉਂਦੇ ਹਾਂ ਘੋੜ ਸਵਾਰੀ ਵਿੱਚ ਸਿਖਾ ਸਿਖਾਉਂਦੇ ਹੈਗੇ ਅਸੀਂ ਹਾਂਜੀ ਆਪਾਂ ਉਹ ਤਾਂ ਜਿਵੇਂ ਆਪਾਂ ਨਾਲ ਨਾਲ ਪ੍ਰੈਕਟਿਸ ਦਾ ਬੱਚੇ ਦੇ ਪ੍ਰੈਕਟਿਸ 'ਤੇ ਡਿਪੈਂਡ ਕਰਦਾ ਜੀ ਜਿਵੇ ਆਪਾਂ ਕਹਿ ਸਕਦੇ ਹਾਂ ਬਈ ਕਈ ਬੱਚੇ ਜਿਹੜੇ ਬਾਹਲੇ ਹੀ ਹੁਸ਼ਿਆਰ ਹੁੰਦੇ ਆ ਉਹ ਭਾਵ ਤਿੰਨ ਚਾਰ ਮਹੀਨਿਆਂ 'ਚ ਹੀ ਸਿਖ ਜਾਂਦੇ ਕਈ ਜਾ ਫਿਰ ਕਈ ਆਪਾਂ ਕਹਿ ਸਕਦੇ ਹਾਂ ਸਾਲ 'ਚ ਸਿੱਖ ਜਾਂਦੇ ਆ ਐਵਰੇਜ ਆਪਾਂ ਕਹਿ ਸਕਦੇ ਆ ਸਾਲ ਕੁ 'ਚ ਸਿੱਖ ਜਾਂਦੇ ਆ ਜੇਕਰ ਹੋਵੇ ਤਾਂ ਦੋਨੇ ਆਪਾਂ ਹਾਂਜੀ ਪੈਸੇ ਆਪਣੇ ਲੱਗ ਜਾਣਗੇ ਪੰਤਾਲੀ ਕੁ ਸੌ ਲੱਗ ਜੂ ਬੱਚੇ 'ਤੇ ਆ ਜੀ ਉਹ ਤਾਂ ਆਪਾਂ ਕਰ ਜਿਵੇਂ ਆਪਾਂ ਕਹਿ ਸਕਦੇ ਹਾਂ ਮਹੀਨੇ ਬਾਅਦ ਕਰਾ ਸਕਦੇ ਹੈਗੇ ਜਿਵੇਂ ਅੱਜ ਤੁਸੀਂ ਹੁਣ ਲਾਇਆ ਤਾਂ ਆਪਾਂ ਮਹੀਨੇ ਬਾਅਦ ਬੱਚੇ ਦੇ ਰੈਡੀ ਰੂਡੀ ਕੰਸੈਂਟ ਨਾਲ ਪੂਰੇ ਆਪਾਂ ਕਰ ਸਕਦੇ ਹਾਂ ਹਾਂਜੀ ਹਾਂਜੀ ਜ਼ਰੂਰ ਹਾਂਜੀ ਹਾਂਜੀ ਪੂਰਾ ਬੱਚੇ ਵੱਲ ਧਿਆਨ ਦਿੱਤਾ ਜਾਂਦਾ ਆਪਾਂ ਪੂਰਾ ਬੱਚੇ ਨੂੰ ਟਰੇਨ ਕਰਦੇ ਹਾਂ ਯਾਨੀ ਕਿ ਯਾਨੀ ਕਿ ਵੱਡੇ ਜਦੋਂ ਵੱਡਾ ਹੁੰਦਾ ਉਦੋਂ ਸਹੀ ਤਰ੍ਹਾਂ ਆਪਣਾ ਸੈਲਫ ਡਿਪੈਂਨ ਡਿਫੈਂਸ ਕਰ ਸਕੇ ਗਤਕਾ ਵੀ ਸਿਖਾਇਆ ਜਾਂਦੀਆਂ ਸਾਰਾ ਕੁਝ ਜਿਵੇਂ ਬੱਚਾ ਗਲਤ ਰਹਿ 'ਤੇ ਰਾਹ 'ਤੇ ਨਹੀਂ ਪੈਂਦਾ ਜੀ ਨਸ਼ਿਆਂ ਵੱਲ ਨਹੀਂ ਜਾਂਦਾ ਹਾਂਜੀ

ਹਾਂਜੀ ਤਾ ਤੁਹਾਡਾ ਹਾਂਜੀ ਮੈਂ ਤੁਹਾਡਾ ਜਿਵੇਂ ਆਪਾਂ ਕਹਿ ਸਕਦੇ ਹਾਂ ਮਾੜਾ ਨਹੀਂ ਹੁੰਦਾ ਬੱਚੇ ਨੂੰ ਇੱਧਰ ਜੋੜਿਆ ਕਰੋ ਫਿਰ ਵਧੀਆ ਬੱਚਾ ਵੀ ਵਧੀਆ ਬਣ ਜੁਗਾ ਯਾਨੀ ਕਿ ਅਧਿਆਤਮਿਕ ਤੋਰ 'ਤੇ ਹਾਂਜੀ ਹਾਂਜੀ ਹਾਂਜੀ ਕਰਾ ਦਿਓ ਜੀ ਫੇਰ ਬੱਚੇ ਦੀ ਐਡਮਿਸ਼ਨ ਓਕੇ ਧੰਨਵਾਦ